ਪੰਜਾਬ ਦੀਆਂ ਪ੍ਰਮੁੱਖ ਟਕਨੋਲਜੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਬਹੁਤ ਸਾਰੀਆਂ ਹਨ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੋਈ ਹੈ ਬਹੁਤ ਤਰ੍ਹਾਂ ਦੇ ਇੱਥੇ ਆਵਿਸ਼ਕਾਰ ਹੁੰਦੇ ਹਨ ਬਹੁਤ ਸਫਲਤਾ ਵੀ ਪ੍ਰਾਪਤ ਕੀਤੀ ਹੈ ਪੰਜਾਬ ਦ ਦੇ ਜਿਹੜੇ ਖਿਡਾਰੀ ਆ ਉਹ ਬਾਹਰਲੇ ਦੇਸ਼ਾਂ ਤੱਕ ਖੇਡ ਕੇ ਆਉਂਦੇ ਹਨ ਜਿੱਥੇ ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ ਪੰਜਾਬ ਨੇ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ ਜਿਹਨਾਂ ਵਿੱਚੋਂ ਨੋਬਲ ਪੁਰਸਕਾਰ ਕਈਆਂ ਨੇ ਨੋਬਲ ਪੁਰਸਕਾਰ ਜਿੱਤਿਆ ਹੈ ਅਤੇ ਅ ਖਿਡਾਰੀ ਹੋ ਗਏ ਅਦਾਕਾਰ ਹੋ ਗਏ ਕਲਾਕਾਰ ਹੋ ਗਏ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਹਨ ਕਈ ਤਰ੍ਹਾਂ ਦੇ ਪੁਰਸਕਾਰ ਨੋਬਲ ਪੁਰਸਕਾਰ ਹੋ ਗਏ ਅਤੇ ਬਹੁਤ ਸਾਰੀਆਂ ਇਹਨਾਂ ਨੇ ਨਵੀਨਤਾਵਾਂ ਵੀ ਹੁੰਦੀਆਂ ਹਨ ਭ ਭਾਈ ਵਾਲੀ ਵੀ ਇਹਨਾਂ 'ਚੋਂ ਬਹੁਤ ਜ਼ਿਆਦਾ ਹੈ ਅਤੇ ਜਿਵੇਂ ਕਿਸੇ ਖ਼ਾਸ ਖੇਤਰ ਦੇ ਮੂਲ ਨਿਵਾਸੀ ਹੁੰਦੇ ਆ ਜਿਹੜੇ ਲੋਕਾਂ ਦਾ ਸਮੂਹ ਹੁੰਦੇ ਹੈਗੇ ਉੱਥੋਂ ਦੇ ਉਹ ਲੋਕਾਂ ਨੂੰ ਦਰਸਾਉਂਦੇ ਆ ਅਤੇ ਆਪਣੇ ਬਾਰੇ ਦੱਸਦੇ ਆ ਜਿੱਥੇ ਆਪਣੇ ਪੰਜਾਬ ਦੀ ਸ਼ਲਾਘਾ ਕਰਵਾਉਂਦੇ ਆ ਜਿਹਨਾਂ ਨਾਲ ਇਹ ਪੰਜਾਬ ਦੀ ਬਹੁਤ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਹਨ